ਟੈਕਨੋਲੋਜੀ ਤਬਦੀਲੀਆਂ ਬਾਰੇ ਇ ਇਸ ਸਮੇਂ ਟੈਕਨੋਲਜੀ ਦੇ ਬਾਰੇ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੋਇਆ ਜੋ ਕਿ ਜਿਹੜੀਆਂ ਪਹਿਲਾਂ ਚੀਜ਼ਾਂ ਨਹੀਂ ਸੀ ਹੈਗੀਆਂ ਜ਼ਿੰਦਗੀ ਦੇ ਵਿੱਚ ਸੰਸਾਰ ਦੇ ਵਿੱਚ ਹੁਣ ਤਾਂ ਬਹੁਤ ਜਿਆਦਾ ਆ ਚੁੱਕੀਆਂ ਹੋਈਆਂ ਨੇ ਜਿੱਥੇ ਪਹਿਲਾਂ ਖਤ ਲਿਖੇ ਜਾਂਦੇ ਸੀ ਹੁਣ ਫੋਨਾਂ ਉੱਤੇ ਹੀ ਵੀਡੀਓ ਕੋਲਾਂ ਹੋ ਜਾਂਦੀਆਂ ਨੇ ਫੋਨ ਉੱਤੇ ਹੀ ਚੈਟ ਹੋ ਜਾਂਦੀ ਹੈ ਸਭ ਕੁਝ ਜਿਹੜੀਆਂ ਪਹਿਲਾਂ ਲੇਡੀਜ ਘਰ ਬਹਿ ਕੇ ਪੋਚੇ ਵਗੈਰਾ ਲਾਉਂਦੀਆਂ ਸੀ ਹੁਣ ਉਹਨਾਂ ਬਾਰੇ ਵੀ ਮਸ਼ੀਨਾਂ ਆ ਚੁੱਕੀਆਂ ਨੇ ਜੋ ਕਿ ਅਸੀਂ ਹੱਥਾਂ ਨਾਲ ਕੱਪੜੇ ਧੋਂਦੇ ਸੀ ਉਹ ਵੀ ਹੁਣ ਮਸ਼ੀਨਾਂ ਆ ਚੁੱਕੀਆਂ ਹੋਈਆਂ ਨੇ ਮਤਲਬ ਪੱਖਿਆਂ ਥੱਲੇ ਨਹੀਂ ਸੀ ਰਿਹਾ ਜਾਂਦਾ ਉਹਨਾਂ ਉਹਨਾਂ ਦੀ ਥਾਂ ਹੁਣ ਏ ਸੀਆਂ ਨੇ ਕੰਮ ਲੈ ਲਿਆ ਹੋਇਆ ਹੈ ਮਤਲਬ ਤਬਦੀਲੀ ਹੁਣ ਬਹੁਤ ਜ਼ਿਆਦਾ ਬਦਲ ਚੁੱਕੀ ਹੋਈ ਹੈ ਜਿੱਥੇ ਪਹਿਲਾਂ ਸਾਰੇ ਜਨਾਨੀਆਂ ਵਗੈਰਾ ਔਰਤਾਂ ਜੋ ਵੀ ਸੀ ਆਪਣੇ ਹੱਥੀਂ ਕੰਮ ਕਰਦੀਆਂ ਸੀ ਹੁਣ ਹਰ ਇੱਕ ਚੀਜ਼ ਦੀ ਮਸ਼ੀਨ ਆ ਚੁੱਕੀ ਹੋਈ ਹੈ ਜਿਹਦੇ ਕਰਕੇ ਮਤਲਬ ਟੈਕਨੋਲੋਜੀ ਬਹੁਤ ਜ਼ਿਆਦਾ ਅਗਾਂਹ ਜਾ ਚੁੱਕੀ ਹੋਈ ਹੈ ਜਿਹਦੇ ਕਿ ਹਰ ਇੱਕ ਚੀਜ਼ ਜੋ ਕਿ ਹੈ ਟੈਕਨੋਲੋਜੀ ਉੱਤੇ ਹੀ ਮਤਲਬ ਡਿਪੈਂਡ ਕਰਦੀ ਹੈ ਕੋਈ ਜਿਵੇਂ ਫੋਨ ਜਿਹੜੇ ਪੈਸੇ ਸੀ ਪਹਿਲਾਂ ਅਸੀਂ ਕੈਸ਼ ਦਿੰਦੇ ਸੀ ਹੁਣ ਜੋ ਕਿ ਮੋਬਾਈਲਾਂ ਉੱਤੇ ਪੇਟੀਐੱਮ ਵਗੈਰਾ ਚੱਲ ਪਏ ਹੋਏ ਨੇ ਜਿਹਦੇ ਕਰਕੇ ਟੈਕਨੋਲੋਜੀ ਨੇ ਮਤਲਬ ਤਬਦੀਲੀ ਇੰਨੀ ਕੁ ਬਦਲ ਦਿੱਤੀ ਹੋਈ ਹੈ ਕਿ ਹਰ ਇੱਕ ਕੰਮ ਹੀ ਹੁਣ ਟੈਕਨੋਲਜੀ ਦੇ ਉੱਪਰ ਹੋ ਰਿਹਾ ਮੋਬਾਇਲਾਂ ਉੱਤੇ ਹੋ ਰਿਹਾ ਲੈਪਟੋਪ ਉੱਤੇ ਹੋ ਰਿਹਾ ਅਰ ਟੈਕਨੋਲੋਜੀ ਤੋਂ ਬਿਨਾਂ ਹੁਣ ਮਤਲਵ ਜ਼ਿੰਦਗੀ ਜਿਵੇਂ ਹੈ ਹੀ ਨਹੀਂ ਜਿਵੇਂ ਜੋ ਪਹਿਲਾਂ ਸੀ ਉਹ ਚੀਜ਼ ਦੀ ਹੁਣ ਬਹੁਤ ਜ਼ਿਆਦਾ ਤਬਦੀਲੀਆਂ ਹੋ ਚੁੱਕੀਆਂ ਹੋਈਆਂ ਸੰਸਾਰ ਵਿੱਚ